ਮੈਂ ਇੱਕ ਦਿਨ ਵਿੱਚ ਦਾਲ ਅਤੇ ਰੋਟੀ ਚਾਵਲ ਖਾਂਦਾ ਹਾਂ ਅਤੇ ਸਲਾਦ ਖਾਂਦਾ ਹਾਂ ਮੇਰੀ ਸਹਿਤ ਲਈ ਚੰਗਾ ਹੈ ਇਹ ਸੰਤੁਲਿਤ ਖੁਰਾਕ ਹੈ ਅਤੇ ਮੈਂ ਹਰੀ ਸਬਜ਼ੀ ਵੀ ਖਾਂਦਾ ਹਾਂ ਕਿਉਂਕਿ ਹਰੀ ਸਬਜ਼ੀ ਵੀ ਪਰਟੀਨ ਦਿੰਦੀ ਹੈ ਸਿਹਤ ਲਈ ਚੰਗੀ ਹੈ ਹਰੀਆਂ ਸਬਜ਼ੀਆਂ ਵਿੱਚ ਜਿਵੇਂ ਕਿ ਤੋਰੀ ਹੋ ਗਈ ਭਿੰਡੀ ਕੱਦੂ ਗਾਜਰ ਸਲਾਦ ਸਾਰੀਆਂ ਸਬਜ਼ੀਆਂ ਖਾਂਦਾ ਹਾਂ ਮੈਂ ਚਾਵਲ ਦਾਲ ਦਾਲ ਅਤੇ ਰੋਟੀ ਸਲਾਦ ਨਾਲ ਖਾਂਦਾ ਹਾਂ ਮੇਰੀ ਸਹਿਤ ਲਈ ਚੰਗੀ ਹੈ ਡੋਕਟਰ ਵੀ ਦੱਸਦੇ ਹਨ ਹਰੀਆਂ ਸਬਜ਼ੀਆਂ ਅਤੇ ਦਾਲ ਚਾਵਲ ਸਲਾਦ ਖਾਣੇ ਚਾਹੀਦੇ ਹੈ ਇਸ ਇਸ ਨਾਲ ਸਿਹਤ ਚੰਗੀ ਰਹਿੰਦੀ ਹੈ ਕੋਈ ਵੀ ਬਿਮਾਰੀ ਨਹੀਂ ਲੱਗਦੀ ਸੰਤੁਲਿਤ ਖਰ ਖੁਰਾਕ ਸਾਡੇ ਲਈ ਬਹੁਤ ਫਾਇਦੇਮੰਦ ਹੈ ਭੋਜਨ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਰੋਜ਼ ਦਿਨ ਵਿੱਚ ਸੰਤੁਲਿਤ ਖੁਰਾਕ ਖਾਣੀ ਚਾਹੀਦੀ ਹੈ ਇਸ ਦੇ ਨਾਲ ਵਿੱਚ ਦਾਲ ਰੋਟੀ ਹਰੀਆਂ ਸਬਜ਼ੀਆਂ ਅਤੇ ਖੀਰੇ ਸਲਾਦ ਪਿਆਜ਼ ਹਰੀਆਂ ਸਬਜ਼ੀਆਂ ਵਿੱਚ ਖਾਣਾ ਚਾਹੀਦਾ ਹੈ ਇਹਦੇ ਵਿੱਚ ਪ੍ਰੋਟੀਨ ਵਗੈਰਾ ਹੁੰਦਾ ਹੈ